ਕਲਾ ਜਗਤ ਵਿੱਚ ਕਿਉਂਕਿ ਕਲਾ 'ਚ ਮੇਰਾ ਥੋੜ੍ਹਾ ਇੰਟਰਸਟ ਹੈ ਕਲਾ ਜਗਤ ਵਿੱਚ ਇੰਸਟਾਗਰਾਮ ਜਿਹੜੀ ਕਿ ਐਪ ਹੈ ਸੋਸ਼ਲ ਮੀਡੀਆ ਉਹ ਕਾਫ਼ੀ ਹੈਲਪ ਕਰਦੀ ਹਨ ਜੁੜੇ ਰਹਿਣ ਨਾਲ ਅੱਜ ਕੱਲ੍ਹ ਦੇ ਨਵੇਂ ਨਵੀਂ ਤਨ ਤਕਨੀਕਾਂ ਜੋ ਵੀ ਡਿਵਲਪਮੈਂਟਸ ਹੁੰਦੀਆਂ ਹਨ ਉਹਨਾਂ ਨਾਲ ਅਸੀਂ ਕਈ ਆਪਣੇ ਮਨਪਸੰਦ ਕਲਾਕਾਰਾਂ ਨੂੰ ਫੋਲੋ ਕਰਦੇ ਹਾਂ ਇਹਦੇ 'ਤੇ ਜਿਹਨਾਂ ਬਾਰੇ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ ਅਤੇ ਉਹਨਾਂ ਦੀ ਅੱਗੇ ਕੀ ਕੀ ਚੱਲਦਾ ਹੈ ਕੰਮ ਕਾਰ 'ਚ ਉਹ ਸਾਨੂੰ ਸਮਝ ਆਉਂਦਾ ਰਹਿੰਦਾ ਹੈ ਦਿਖਦਾ ਰਹਿੰਦਾ ਹੈ ਜਿਹਦੇ ਨਾਲ ਅਸੀਂ ਵੀ ਪ੍ਰਭਾਵਿਤ ਹੋ ਕੇ ਫਿਰ ਅੱਗੇ ਕੰਮ ਕਰਦੇ ਹਾਂ ਹੋਰ ਸ਼ਹਿਰ ਵਿੱਚ ਕਈ ਐਗਜੀਬਿਸ਼ਨ ਕਹਿ ਲਓ ਉਹ ਹੁੰਦੀਆਂ ਹਨ ਜਾਂ ਈਵੈਂਟ ਹੁੰਦੇ ਹਨ ਉਹ ਅਸੀਂ ਅਟੈਂਡ ਕਰਨ ਜਾਈਦਾ ਹੈ ਜਿਹਨਾਂ ਬਾਰੇ ਵੀ ਸਾਨੂੰ ਇੱਦਾਂ ਔਨਲਾਈਨ ਐਪਸ ਤੋਂ ਹੀ ਪਤਾ ਲੱਗਦਾ ਹੈ ਉੱਥੇ ਫਿਰ ਹੋਰ ਕਲਾਕਾਰਾਂ ਨਾਲ ਮਿਲ ਕੇ ਗੱਲਬਾਤ ਹੋ ਕੇ ਵਿਚਾਰ ਜਦੋਂ ਵਰਤੇ ਜਾਂਦੇ ਹਨ ਐਕਸਚੇਂਜ ਹੁੰਦੇ ਹਨ ਉਹ ਤੋਂ ਵੀ ਕਾਫ਼ੀ ਪਤਾ ਲੱਗਦਾ ਹੈ ਅੱਗੇ ਕੀ ਚੱਲ ਰਿਹਾ ਟੀ ਵੀ 'ਤੇ ਅਸੀਂ ਇੰਨਾ ਨਹੀਂ ਦੇਖਦੇ ਅਤੇ ਉਹਦੇ ਤੋਂ ਤਾਂ ਨਹੀਂ ਕੁਛ ਅਪਡੇਟ ਮਿਲਦਾ ਹੋਰ ਇਹ ਦੋ ਚੀਜ਼ਾਂ ਹੀ ਹਨ ਸੋਸ਼ਲ ਮੀਡੀਆ ਕਹਿ ਲਓ ਅਤੇ ਬਾਕੀ ਮਿਲ ਕੇ ਐਗਜੀਬਿਸ਼ਨਸ ਬਹਾਨੇ ਹੁੰਦੇ ਹਨ ਜਿਹਨਾਂ 'ਤੇ ਮਿਲ ਕੇ ਸਾਨੂੰ ਅੱਗੇ ਇਹਨਾਂ ਬਾਰੇ ਪਤਾ ਚੱਲਦਾ ਹੈ